ਭਾਰਤੀ ਆਵਾਜਾਈ ਪ੍ਰਣਾਲੀ ਬਹੁਤ ਹੀ ਵਧੀਆ ਹੈ ਅਸੀਂ ਕਈ ਤਰ੍ਹਾਂ ਨਾਲ ਪ੍ਰਣਾਲੀ ਕਰਦੇ ਹਾਂ ਜਿਵੇਂ ਆਪਣੀ ਗੱਡੀ 'ਤੇ ਸਰਕਾਰੀ ਬੱਸਾਂ 'ਤੇ ਪ੍ਰਾਈਵੇਟ ਬੱਸਾਂ 'ਤੇ ਜਹਾਜ਼ਾਂ 'ਤੇ ਟਰੇਨਾਂ 'ਤੇ ਪਰ ਆਪਣੀ ਗੱਡੀ ਵਿੱਚ ਸਫਰ ਕਰਨ ਦਾ ਮਜ਼ਾ ਬਹੁਤ ਵਧੀਆ ਹੈ ਭਾਰਤ ਦੀਆਂ ਸੜਕਾਂ ਬਹੁਤ ਵਧੀਆ ਹਨ ਇਸ ਲਈ ਸਫਰ ਦੌਰਾਨ ਬਹੁਤ ਵਧੀਆ ਲੱਗਦਾ ਹੈ ਕਈ ਸਵਾਰੀਆਂ ਨੂੰ ਸਫਰ ਦੇ ਦੌਰਾਨ ਮੋਸ਼ਨ ਸਿਕਨੈਸ ਵੀ ਹੁੰਦੀ ਹੈ ਜਿਸ ਨਾਲ ਉਹਨਾਂ ਨੂੰ ਵੋਮਿਟਿੰਗ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਆਪਣੀ ਗੱਡੀ ਖੜ੍ਹਨ ਨਾਲ ਅਸੀਂ ਜਿੱਥੇ ਮਰਜ਼ੀ ਰੁਕ ਸਕਦੇ ਹਾਂ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਅੱਜ ਦੇ ਸਮੇਂ ਵਿੱਚ ਸੜਕਾਂ ਵੀ ਬਹੁਤ ਵਧੀਆ ਹਨ ਅਸੀਂ ਖਾਣ ਪੀਣ ਲਈ ਵੀ ਜਿੱਥੇ ਮਰਜ਼ੀ ਢਾਬਿਆਂ 'ਤੇ ਰੁਕ ਸਕਦੇ ਹਾਂ ਅਤੇ ਰੈਸਟ ਕਰਨ ਲਈ ਵੀ ਅਸੀਂ ਜਿੱਥੇ ਮਰਜ਼ੀ ਰੁਕ ਸਕਦੇ ਹਾਂ ਅਜੋਕੇ ਸਮੇਂ ਵਿੱਚ ਆਪਣੀ ਗੱਡੀ 'ਤੇ ਸਫਰ ਕਰਨਾ ਬਹੁਤ ਹੀ ਵਧੀਆ ਹੈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੀ ਗੱਡੀਆਂ 'ਤੇ ਸਫਰ ਕਰਨਾ ਚਾਹੀਦਾ ਹੈ ਲੋਕ ਮੋਟਰਸਾਈਕਲ 'ਤੇ ਵੀ ਬਹੁਤ ਸਫਰ ਕਰਦੇ ਹਨ ਪਿਛਲੇ ਸਾਲ ਮੈਂ ਹੇਮਕੁੰਟ ਸਾਹਿਬ ਵੀ ਆਪਣੀ ਗੱਡੀ ਲੈ ਕੇ ਗਿਆ ਸੀ ਅਤੇ ਉਸ ਤੋਂ ਪਿਛਲੇ ਸਾਲ ਮੈਂ ਮੋਟਰਸਾਈਕਲ 'ਤੇ ਵੀ ਗਿਆ ਸੀ ਸੜਕਾਂ ਵੀ ਬਹੁਤ ਵਧੀਆ ਹਨ ਅਤੇ ਸਾਨੂੰ ਕੋਈ ਦਿੱਕਤ ਨਹੀਂ ਹੋਈ